ਅਸੀਂ ਵਿਆਹ ਵਾਲੀ ਕੁੜੀ ਨੂੰ ਗਿਫਟ ਦਿੰਦੇ ਹਾਂ ਜਿਸ ਦੇ ਵਿੱਚ ਵਿਆਹ ਵਾਲੀ ਕੁੜੀ ਦੇ ਕੱਪੜੇ ਗਹਿਣੇ ਹਾਰ ਸ਼ਿੰਗਾਰ ਵਾਸਤੇ ਸਮਾਨ ਦਿੰਦੇ ਹਾਂ ਜਿਸ ਵਿੱਚ ਉਹਦੇ ਪੰਜ ਸੂਟ ਵੀ ਅਸੀਂ ਦਿੰਦੇ ਹਾਂ ਵਿਆਹ ਵਾਲੀ ਕੁੜੀ ਨੂੰ ਹੋਰ ਅਸੀਂ ਬਹੁਤ ਸਾਰੇ ਗਿਫਟ ਦਿੰਦੇ ਹਾਂ ਜਿਹਦੇ ਵਿੱਚ ਉਸਨੂੰ ਜੋ ਪਸੰਦ ਹੋਵੇ ਅਸੀਂ ਉਹ ਵੀ ਲੈ ਕੇ ਦਿੰਦੇ ਹਾਂ ਹੋਰ ਗੱਡੀ ਦੀ ਜੇ ਸਾਡੀ ਪਹੁੰਚ ਹੋਵੇ ਅਸੀਂ ਗੱਡੀ ਵੀ ਦਿੰਦੇ ਹਾਂ ਜੇ ਮੋਟਰਸਾਈਕਲ ਦੀ ਪਹੁੰਚ ਹੋਵੇ ਮੋਟਰਸਾਈਕਲ ਦੇ ਦਿੰਦੇ ਹਾਂ ਹੋਰ ਜੋ ਘਰ ਘਰਸਤੀ ਦਾ ਸਮਾਨ ਹੁੰਦਾ ਆ ਉਹਦੀ ਜ਼ਰੂਰਤ ਮੁਤਾਬਿਕ ਅਸੀਂ ਉਹ ਵੀ ਉਹਨਾਂ ਨੂੰ ਲੈ ਕੇ ਦਿੰਦੇ ਹਾਂ ਹੋਰ ਜੋ ਵਿਆਹ ਵਾਲੀ ਕੁੜੀ ਦੀ ਕੋਈ ਡਿਮਾਂਡ ਉਹ ਸਾਨੂੰ ਕਰਦੀ ਆ ਅਸੀਂ ਉਹ ਵੀ ਉਹਦੀ ਪੂਰੀ ਕਰਦੇ ਹਾਂ

ਹੋਰ ਅਸੀਂ ਕੁੜੀ ਦੇ ਮੁਤਾਬਿਕ ਜੋ ਦਾਜ ਦੀ ਜ਼ਰੂਰਤ ਹੁੰਦੀ ਆ ਉਹ ਦਿੰਦੇ ਹਾਂ ਜੋ ਸਾਡੀ ਪਹੁੰਚ ਦੇ ਮੁਤਾਬਿਕ ਹੁੰਦਾ ਹੈ ਦਾਜ ਉਹ ਅਸੀਂ ਵਿਆਹ ਵਾਲੀ ਕੁੜੀ ਨੂੰ ਦਿੰਦੇ ਹਾਂ ਪੁਰਾਣੇ ਜਮਾਨੇ ਤੋਂ ਜੋ ਰੀਤੀ ਰਿਵਾਜ਼ ਚੱਲ ਰਹੇ ਦ ਦਾਜ ਦੇ ਉਹ ਜਮਾਨੇ ਅੱਜ ਕੱਲ੍ਹ ਹੌਲੀ ਹੌਲੀ ਖਤਮ ਹੁੰਦੇ ਜਾ ਰਹੇ ਨੇ ਹੁਣ ਜੋ ਕੋਈ ਵਿਆਹ ਵਾਲੀ ਕੁੜੀ ਆਪਣੇ ਕੋਲੋਂ ਮੰਗੇ ਜੋ ਚੀਜ਼ ਗਿਫਟ ਉਹ ਹੀ ਉਹਨੂੰ ਦਿੰਦੇ ਹਾਂ ਕੋਈ ਜ਼ਬਰਦਸਤੀ ਕੋਈ ਉਹ ਨਹੀਂ ਹੁੰਦਾ ਕਿ ਦਾਜ ਦੇਣਾ ਹੀ ਦੇਣਾ ਬਾਕੀ ਹਰ ਇੱਕ ਦੀ ਹਰ ਹਰ ਕੋਈ ਮਾਂ ਪਿਓ ਸੋਚਦਾ ਹੈ ਕਿ ਅਸੀਂ ਆਪਣੀ ਬੇਟੀ ਨੂੰ ਹਰ ਚੀਜ਼ ਦੇ ਕੇ ਭੇਜੀਏ ਖਾਲੀ ਹੱਥ ਕੋਈ ਨਹੀਂ ਭੇਜਦਾ ਹਰ ਕੋਈ ਆਪਣੀ ਬੇਟੀ ਨੂੰ ਖੁਸ਼ ਕਰਕੇ ਹੀ ਭੇਜਦਾ ਹੈ